ਹੈਲੋ ਤੁਸੀਂ ਫਲਿੱਪਕਾਰਟ ਤੋਂ ਬੋਲ ਰਹੇ ਹੋ ਹਾਂਜੀ ਮੇਰਾ ਨਾਮ ਆਸ਼ੂ ਭਠੇਜਾ ਹੈ ਮੈਂ ਤੁਹਾਡੇ ਫਲਿਪਕਾਰਟ 'ਤੇ ਇੱਕ ਮੋਬਾਈਲ ਆਰਡਰ ਕੀਤਾ ਸੀ ਕਰ ਰਹੀ ਹਾਂ ਉਹਦੇ ਨਾਲ ਹੈਡਫੋਨ ਵੀ ਐਡ ਹੋ ਗਏ ਨੇ ਉਹ ਗਲਤੀ ਨਾਲ ਹੋ ਗਏ ਨੇ ਹਾਂਜੀ ਮੈਨੂੰ ਉਸ ਦੀ ਜ਼ਰੂਰਤ ਨਹੀਂ ਹੈ ਪਰ ਮੈਂ ਉਹਨੂੰ ਉੱਥੋਂ ਹਟਾਉਣਾ ਚਾਹ ਰਹੀ ਹਾਂ ਪਰ ਉਹ ਡਿਲੀਟ ਨਹੀਂ ਹੋ ਰਹੇ ਠੀਕ ਹੈ ਉਹਨੂੰ ਕਿਸ ਤਰ੍ਹਾਂ ਕੀਤਾ ਜਾਏਗਾ ਮੇਰੀ ਹੈਲਪ ਕਰੋ ਹਾਂਜੀ ਮੇਰਾ ਅਕਾਊਂਟ ਨੰਬਰ ਡਬਲ ਨਾਈਨ ਵੰਨ ਫੌਰ ਨਾਈਨ ਏਟ ਟ੍ਰਿਪਲ ਜ਼ੀਰੋ ਥ੍ਰੀ ਹੈ ਇਹ ਹੋ ਨਹੀਂ ਰਿਹਾ ਜੀ ਹਾਂਜੀ ਠੀਕ ਹੈ ਹਾਂਜੀ ਹਾਂਜੀ ਕਰਤਾ ਜੀ ਕਰਤਾ ਹੋ ਗਿਆ ਹੁਣ ਮੈਂ ਇਕੱਲਾ ਮੋਬਾਈਲ ਹੀ ਆਰਡਰ ਕਰਾਂਗੀ ਹਾਂਜੀ ਠੀਕ ਹੈ ਥੈਂਕ ਯੂ ਜੀ